ਦਸ ਸਤੂਬਰ ਦੋ ਹਜ਼ਾਰ ਵੀਹ ਗਿਆਰਾਂ ਜਨਵਰੀ ਦੋ ਹਜ਼ਾਰ ਚਾਰ ਛੱਬੀ ਸਤੰਬਰ ਦੋ ਹਜ਼ਾਰ ਦੋ ਛੱਬੀ ਦਸੰਬਰ ਦੋ ਹਜ਼ਾਰ ਤਿੰਨ ਗਿਆਰਾਂ ਮਾਰਚ ਉੱਨੀ ਸੌ